ਸ਼ਿਲਕ ਸ਼ਿਲਪਕਾਰੀ ਖੇਤਰ ਵਿੱਚ ਕਲਾ ਜਿਹੜੀ ਹੈਗੀ ਹੈ ਇਹਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਆਪਣੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹੈ ਜਿਹੜਾ ਕਿ ਇਨਵਾਇਰਮੈਂਟ ਨੂੰ ਵਾਤਾਵਰਨ ਨੂੰ ਨੁਕਸਾਨ ਦਿੰਦੀਆਂ ਨੇ ਜਿਵੇਂ ਅੱਜ ਕੱਲ੍ਹ ਮੇਨ ਜਿਹੜਾ ਹੈਗਾ ਮੁੱਦਾ ਹੈਗਾ ਉਹ ਪਲਾਸਟਿਕ ਹੈਗਾ ਹੁਣ ਬਹੁਤ ਜਗ੍ਹਾ ਤੇ ਆਪਾਂ ਨੇ ਦੇਖਣ ਨੂੰ ਮਿਲਿਆ ਕਿ ਪਲਾਸਟਿਕ ਦੀਆਂ ਚੀਜ਼ਾਂ ਬਹੁਤ ਜਗ੍ਹਾ ਸਿੱਟੀਆਂ ਜਾਂਦੀਆਂ ਜਾਨਵਰਾਂ ਦੇ ਅੰਦਰ ਜਾਂਦੀਆਂ ਨੇ ਉਹ ਨੁਕਸਾਨ ਪਹੁੰਚਾਉਂਦੀਆਂ ਨੇ ਉਹਨਾਂ ਨੂੰ ਕੀ ਚਾਹੀਦਾ ਕਿ ਉਹਨਾਂ ਨੂੰ ਅਸੀਂ ਉਹਦੇ ਵਿੱਚ ਲਈਏ ਚੰਗੇ ਉਹਦੇ ਵਿੱਚ ਲਈਏ ਆਪਣਾ ਬਣਾਈਏ ਉਹਨਾਂ ਨੂੰ ਜਿਸ ਤਰ੍ਹਾਂ ਉਹਨੂੰ ਪੌਦੇ ਲਗਾਉਣਾ ਯਾ ਇਹੋ ਜਿਹੀਆਂ ਚੀਜ਼ਾਂ ਲਗਾਉਣਾ ਜਿਹੜਾ ਉਹ ਇਨਵਾਇਰਮੈਂਟ ਨੂੰ ਸਾਫ਼ ਸੁਥਰਾ ਵੀ ਰੱਖਣ ਅਤੇ ਘਰ ਨੂੰ ਸਜਾਉਣ ਦੇ ਵੀ ਕੰਮ ਆਉਣ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਸ ਤਰ੍ਹਾਂ ਕਿ ਆਪਣਾ ਬਹੁਤ ਖ਼ਰਾਬ ਘਰ ਵਿੱਚ ਕੱਪੜੇ ਹੁੰਦੇ ਆ ਉਹਨਾਂ ਦੀ ਆਪਾਂ ਉਹਨਾਂ ਨੂੰ ਦੁਬਾਰਾ ਉਹਨੂੰ ਯੋਗ ਵਿੱਚ ਲਿਆ ਕੇ ਉਹਨਾਂ ਦੇ ਮੈਟ ਬਣਾ ਲਈਏ ਜਾਂ ਕੁੱਛ ਏਹੇ ਜਹੀਆਂ ਚੀਜ਼ਾਂ ਬਣਾ ਲਈਏ ਜ ਜਿਹਦਾ ਅੱਗੇ ਤੋਂ ਅੱਗੇ ਮਤਲਬ ਵਰਤੋਂ ਹੁੰਦੀ ਰਹੇ